ਪਹਿਲਾ ਮੈਂ ਕਿਤਾਬਾਂ ਨੂੰ ਆਪਣੇ ਕੋਲ ਰੱਖਦਾ ਸੀ ਅਤੇ ਅੱਜ ਕੱਲ੍ਹ ਮੈਨੂੰ ਕਿਤਾਬਾਂ ਨੂੰ ਨਾਲ਼ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਮੈਂ ਹੁਣ ਪੀ ਡੀ ਐੱਫ ਡਾਊਨਲੋਡ ਕਰਕੇ ਆਪਣੇ ਫ਼ੋਨ ਦੇ ਵਿੱਚ ਸਟੋਰ ਕਰਕੇ ਰੱਖਦਾ ਹਾਂ ਮੈਂ ਜਦੋਂ ਵੀ ਕਿਤੇ ਜਾਂਦਾ ਅਗਰ ਮੈਨੂੰ ਕਿਸੀ ਵੀ ਬੁੱਕ ਦੀ ਲੋੜ ਪੈਂਦੀ ਹੈ ਤਾਂ ਮੈਂ ਪੀ ਡੀ ਐੱਫ ਓਪਨ ਕਰਕੇ ਉਹਦੀ ਵਰਤੋਂ ਕਰ ਲੈਂਦਾ ਹਾਂ